ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਨਾ ਤੁਹਾਡੇ ਤੋਂ ਇੱਕ ਜਾਣਕਾਰੀ ਲੈਣਾ ਚਾਹੁੰਦੀ ਹਾਂ ਐਕਚੁਲੀ ਮੈਂ ਨਾ ਅੰਮ੍ਰਿਤਸਰ ਵਿਜ਼ਿਟ ਹੋਣ ਵਾਲੀ ਸੀਗੀ ਅਤੇ ਮੈਂ ਨਾ ਤੁਹਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਕੁਛ ਪੁੱਛਣਾ ਚਾਹੁੰਦੀ ਹਾਂ ਤੁਸੀਂ ਦੱਸ ਸਕੋਗੇ ਬੱਸ ਉਹ ਹਾਂ ਕੱਲ੍ਹ ਪਰਸੋਂ ਤੱਕ ਆਉਂਗੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਅਗਰ ਮੈਂ ਤੁਹਾਡੇ ਕੋਲ ਹੋਰ ਵੀ ਕੁਛ ਜਾਣਕਾਰੀ ਲੈਣੀ ਹੋਵੇਗੀ ਤਾਂ ਮੈਂ ਤੁਹਾਨੂੰ ਕੋਂਟੈਕਟ ਕਰਾਂਗੀ ਫਿਰ ਤੋਂ ਓਕੇ ਧੰਨਵਾਦ